ਹੈਲੋ ਹਾਂਜੀ ਤਾਂ ਗੱਲ ਕਰ ਰਹੇ ਹੋ ਮੈਂ ਹਨ ਮੈਂ ਪੁਛਤਾ ਸੀ ਵੀ ਤੁਹਾਡਾ ਕਾਲਜ ਦਾ ਕੀ ਟਾਈਮ ਟੇਬਲ ਹੈ ਕਿ ਤੁਸੀਂ ਕਾਲਜ ਜਾ ਕੇ ਕੀ ਕਰਦੇ ਹੋ ਕਿ ਨਹੀਂ ਕਰਦੇ ਅੱਛਾ ਕਿੰਨੇ ਆਕੇ ਪਹਿਲਾਂ ਕੀ ਕੀਤਾ ਤੁਸੀਂ

ਤੇ ਮੈਂ ਮੈਂ ਕੱਲ ਆਇਆ ਸੀ ਤੇ ਆਪਣੇ ਕਲਾਸ ਦੇ ਵਿੱਚ ਆਪਣੇ ਟੈਕਸਾਂ ਤੇ ਉਦਾਂ ਹੀ ਡਸਟ ਵਗੈਰਾ ਪਈ ਹੋਈ ਸੀ ਤੇ ਜੀ ਲੇਕਿਨ ਹਾਂਜੀ ਹਾਂਜੀ ਔਰ ਮੈਂ ਅੱਜ ਵੀ ਆ ਕੇ ਸੁਬਹ ਦੋ ਪਹਿਲਾਂ ਵਾਲੀਆਂ ਤੇ ਕਿਸੇ ਨੇ ਵੀ ਨਹੀਂ ਸੁਣੀ ਉਦੋਂ ਵੀ ਨਹੀਂ ਆਇਆ ਕੋਈ

ਫਿਰ ਵੀ ਅੱਗੇ ਤੋਂ ਧਿਆਨ ਰੱਖਿਆ ਕਰੋ ਤੁਸੀਂ ਇਨਾ ਗੱਲਾਂ ਦਾ ਛੋਟੀਆਂ ਛੋਟੀਆਂ ਗੱਲਾਂ ਦਾ ਤੁਸੀਂ ਸਾਰੇ ਇਸ ਤੋਂ ਇਲਾਵਾ ਕੀ ਕੰਮ ਕਰਦੇ ਹੋਰ ਤੁਸੀਂ ਹਾਂਜੀ ਠੀਕ ਐ ਠੀਕ ਐ ਔਰ ਇਸ ਤੋਂ ਇਲਾਵਾ ਤੁਸੀਂ ਹੋਰ ਪੁਲਿਸ ਤੋਂ ਇਲਾਵਾ ਹੋਰ ਕੋਈ ਕੰਮ ਕਰਦੇ ਹੋ ਕਿ ਇਸ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕਰਦੇ ਠੀਕ ਓਕੇ